ਪਿੰਡਾਂ ਵੋਚ ਵਿੱਚ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾ ਰਹੀਆਂ ਨ ਖੇਡਾਂ ਨਾਲ ਲੋਕ ਆਪਸ ਵਿੱਚ ਬਹੁਤ ਵਧੀਆ ਸਾਂਝ ਪਾਉਂਦੇ ਆ ਅਤੇ ਸਕੂਲਾਂ ਵਿੱਚ ਵੀ ਖੇਡਾਂ ਖੇਡੀਆਂ ਜਾਂਦੀਆਂ ਹਨ ਖੋ ਖੋ ਕ੍ਰਿਕਟ ਬਾਂਦਰ ਕਿੱਲਾ ਲੁਕਣ ਮਿਚੀ ਫੜਨੀਚੀ ਬਰਫ ਪਾਣੀ ਹੋਰ ਖੇਡਾਂ ਖੇਡੀਆਂ ਜਾਂਦੀਆਂ ਹਨ ਜਿਨ੍ਹਾਂ ਨਾਲ ਆਪਸ ਵਿੱਚ ਉਹ ਬਹੁਤ ਵਧੀਆ ਇੱਕ ਦੂਏ ਨੂੰ ਜਾਣਦੇ ਆ ਅਤੇ ਰਸ ਦੂਜੇ ਬੰਦੇ ਦਾ ਸਤਿਕਾਰ ਕਰਦੇ ਆ ਖੇਡਣ ਨਾਲ ਬੱਚਾ ਤੰਦਰੁਸਤ ਰਹਿੰਦਾ ਅਤੇ ਸਿਹਤ ਪੱਖੋਂ ਵਧੀਆ ਰਹਿੰਦਾ ਹੈ ਖੇਡਾਂ ਖੇਡਣ ਨਾਲ ਸਾਡਾ ਸਰੀਰ ਬਹੁਤ ਹੀ ਤੰਦਰੁਸਤ ਰਹਿੰਦਾ ਹੈ ਅਤੇ ਮਤਲਬ ਆਪਸ ਵਿੱਚ ਬਹੁਤ ਜ਼ਿਆਦਾ ਪਿਆਰ ਸਤਿਕਾਰ ਬਹੁਤ ਜ਼ਿਆਦਾ ਵਧੀਆ ਸਬੰਧਿਤ ਹੁੰਦਾ ਹੈ ਦੇਖ ਖੇਡਣਾ ਸਕੂਲਾਂ ਵਿੱਚ ਵੀ ਖੇਡਾਂ ਖੇਡੀਆਂ ਨੂੰ ਖੋ ਖੋ ਖੇਡੀਆਂ ਜਾਂਦੀਆਂ ਹਨ ਖੋ ਖੋ ਵਿੱਚ ਜਵਾਕ ਜ਼ਿਲ੍ਹਾ ਸਟੇਟ ਨੈਸ਼ਨਲ ਤੱਕ ਜਾਂਦਾ ਹੈ ਜਿਸ ਨਾਲ ਸਕੂਲ ਦਾ ਨਾਮ ਅਤੇ ਪਿੰਡ ਦਾ ਨਾਮ ਵੀ ਉੱਚਾ ਹੁੰਦਾ ਹੈ ਕਈ ਸਕੂਲਾਂ ਵਿੱਚ ਵਾਸ਼ਟਰੀਬਾਲ ਵੀ ਹੁੰਦੀ ਹੈ ਉਸ 'ਤੇ ਵੀ ਐਵੇ ਹੁੰਦਾ ਜ਼ਿਲ੍ਹਾ ਪੱਧਰ ਸਟੇਟ ਪੱਧਰ ਐਵੇਂ ਦਾ ਕੁਛ ਮਤਲਬ ਐਵੇਂ ਖੇਡੀਆਂ ਜਾਂਦੀਆਂ ਹਨ ਕਈ ਸਕੂਲਾਂ ਵਿੱਚ ਫੁਟਬਾਲ ਹੈਂਡਬਾਲ ਵਿੱਚ ਜਵਾਕ ਭਾਗ ਲੈਂਦੇ ਹਨ ਫੁਟਬਾਲ ਦੇ ਜਵਾਕਾਂ ਬਹੁਤ ਵਧੀਆ ਖੇਡਦੇ ਹਨ ਅਤੇ ਵਧੀਆ ਪ੍ਰਾਪ ਟੀਮ ਪ੍ਰਾਪਤ ਕਰਕੇ ਅਗਲੇ ਸਟੇਟ ਤੱਕ ਜਾਂਦੇ ਆ ਅਤੇ ਅੱਜ ਕੱਲ੍ਹ ਦੀਆਂ ਕੁੜੀਆਂ ਹੈਂਡਬਾਲ ਜ਼ਿਆਦਾ ਖੇਡਦੇ ਨੇ ਹੈਂਡਬਾਲ ਦੇ ਵਿੱਚ ਆ ਕੁੜੀਆਂ ਵਧੀਆ ਖੇਡਣਾ ਜੂਨ ਵਿੱਚ ਫਸਟ ਪੁਜੀਸ਼ਨ ਲਿਆ ਕੇ ਹੋਰ ਵਧੀਆ ਗੇਮਾਂ ਖੇਡਦੀਆਂ ਅਤੇ ਆਪਣੇ ਸਕੂਲ ਦਾ ਆਪਣੇ ਪਿੰਡ ਦਾ ਹੈ ਨਾ ਨਾਮ ਉੱਚਾ ਕਰ ਦੀਆਂ ਅਤੇ ਇਸ ਲਈ ਇਹਨਾਂ ਦੇ ਇਹਨਾਂ ਦੀ ਮਿਹਨਤ 'ਤੇ ਹੀ ਉਹਨਾਂ ਨੂੰ ਸਮਨਤ ਕੀਤਾ ਜਾਂਦਾ ਇਸ ਕਰਕੇ ਕਈ ਜਵਾਕਾਂ ਦੇ ਖੇਡਾਂ ਮਤਲਬ ਸੱਟ ਵਜਦੀ ਅ ਅਤੇ ਉਹ ਦੁਹਰੀ ਵਾਰ ਖੇਡਣ ਸ਼ੁਰੂ ਕਰ ਦਿੰਦੇ ਆ